ਹੈਲੋ ਹੈਲੋ ਹੈਲੋ ਹੈਲੋ ਹੈਲੋ ਹੈਲੋ ਹਾਂਜੀ ਹਾਂਜੀ ਆਵਾਜ਼ ਆ ਰਹੀ ਆ ਹਾਂਜੀ ਹਾਂਜੀ ਹਾਂਜੀ ਹਾਂਜੀ ਸਭ ਹਾਂਜੀ ਹਾਂਜੀ ਵਧੀਆ ਜੀ ਤੁਸੀਂ ਸੁਣਾਓ ਕੁਛ ਨਹੀਂ ਬਸ ਜੀ ਖਾਣਾ ਖਾ ਕੇ ਹੱਟੇ ਸੀਗੇ ਇਹਨੂੰ ਮੈਂ ਤਾਂ ਸੀ ਬੀ ਐਸ ਈ ਸਕੂਲ 'ਚ ਪਾਇਆ ਏ ਹਾਂਜੀ ਸੀ ਬੀ ਐਸ ਈ ਸਕੂਲ ਜੀ ਸੈਂਟਰਲ ਬੋਰਡ ਓਫ ਸਕੈਂਡਰੀ ਐਜੂਕੇਸ਼ਨ ਅਤੇ ਉਹਦੇ ਅੰਡਰ ਮੈਂ ਇਹਨੂੰ ਪਾਇਆ ਹੋਇਆ ਅਤੇ ਬਹੁਤ ਵਧੀਆ ਸਟਡੀ ਏ ਬਹੁਤ ਵਧੀਆ ਸਾਰਾ ਕੁਛ ਹੀ ਤੁਸੀਂ ਵੀ ਆਪਣੇ ਬੱਚੇ ਨੂੰ ਸੀ ਬੀ ਐਸ ਈ 'ਚ ਪਾਇਓ ਪੰਜਾਬ ਬੋਰਡ ਤਾਂ ਆਪਣੀ ਸਟੇਟ ਦਾ ਬੋਰਡ ਹੈ ਨਾ ਉਹਦੇ 'ਚ ਨਾਲੇ ਜਿਹੜਾ ਆ ਸਾਰਾ ਮੀਡੀਅਮ ਪੰਜਾਬੀ ਹੁਣਾ ਆ ਅਤੇ ਸੀ ਬੀ ਐਸ ਈ ਦੇ ਤਾਂ ਮੀਡੀਅਮ ਇੰਗਲਿਸ਼ ਹੁਣ ਤੁਹਾਨੂੰ ਪਤਾ ਇੰਗਲਿਸ਼ ਇੰਟਰਨੈਸ਼ਨਲ ਲੈਂਗੁਏਜ਼ ਆ ਅਤੇ ਬੱਚੇ ਨੇ ਅੱਗੇ ਫਊਚਰ ਤੁਹਾਨੂੰ ਪਤਾ ਕਿਹੜਾ ਜ਼ਰੂਰੀ ਹੈ ਕਿ ਸਾਰਾ ਉਹਨੇ ਪੰਜਾਬ 'ਚ ਹੀ ਰਹਿਣਾ ਏ ਆ ਅਤੇ ਅੱਗੇ ਉਹ ਪੰਜਾਬ ਤੋਂ ਬਾਹਰ ਜਾਏਗਾ ਤਾਂ ਉਹਦੇ ਕੰਮ ਆਏਗੀ ਉਹਦਾ ਤੁਹਾਨੂੰ ਪਤਾ ਸੀ ਬੀ ਐਸ ਈ ਸੈਂਟਰ ਦਾ ਬੋਰਡ ਆ ਪਰ ਜਿਹੜੇ ਮੋਸਟਲੀ ਮਤਲਬ ਸੀ ਬੀ ਐਸ ਈ ਹੀ ਜਿਹੜਾ ਹੈਗਾ ਆ ਉੱਪਰ ਆ ਪੰਜਾਬ ਬੋਰਡ ਦਾ ਹਰਿਆਣਾ ਬੋਰਡ ਹਿਮਾਚਲ ਬੋਰਡ ਸਟੇਟ ਦੇ ਬੋਰਡ ਹੁੰਦੇ ਨੇ ਨਾ ਇੱਦਾਂ ਪੰਜਾਬ ਬੋਰਡ ਜਿਹੜਾ ਆ ਉਹ ਆਪਣੀ ਸਟੇਟ ਦਾ ਬੋਰਡ ਆ ਹੈ ਨਾ ਉਹਦੇ 'ਚ ਪੰਜਾਬੀ ਮੀਡੀਅਮ ਏ ਆ ਅਤੇ ਸੀ ਬੀ ਐਸ ਈ ਬੋਰਡ ਜਿਹੜਾ ਸੈਂਟਰ ਗੌਰਮੈਂਟ ਦੀਆਂ ਜਿੰਨੀਆਂ ਵੀ ਸੈਂਟਰ ਦੀਆਂ ਜੋਬਸ ਬੱਚੇ ਕਰਦੇ ਨੇ ਅੱਗੇ ਉਹਨੂੰ ਉਹਦਾ ਵੀ ਬੈਨੀਫਿਟ ਰਹੇਗਾ ਨਾਲੇ ਸੈਂਟਰ ਦੀਆਂ ਅਤੇ ਐਕਟੀਵਿਟੀਜ਼ ਵੀ ਹੋਰ ਵੀ ਜਿੰਨਾ ਵੀ ਮਤਲਬ ਉਹ ਚੀਜ਼ਾਂ ਬਹੁਤ ਹੁੰਦੀਆਂ ਨੇ ਸੈਂਟਰ ਦੀਆਂ ਅਤੇ ਉਹ ਸਾਰੀਆਂ ਸੀ ਬੀ ਐਸ ਈ ਸਕੂਲਾਂ ਵਿੱਚ ਸੈਂਟਰ ਦੀਆਂ ਪੋਲਸੀਸ ਜਿਹੜੀਆਂ ਇੰਪਲੀਮੈਂਟ ਹੁੰਦੀਆਂ ਏ ਹੈ ਨਾ ਅਤੇ ਜਿਹੜੇ ਪੰਜਾਬ ਦਾ ਬੋਰਡ ਉਹਦੇ 'ਚ ਤਾਂ ਪੰਜਾਬ ਵਾਲੀਆਂ ਹੀ ਚਲਣੀਆਂ ਆਂ ਅਤੇ ਫਿਰ ਮੈਂ ਤਾਂ ਸਾਰਾ ਕੁਛ ਦੇਖ ਕੇ ਸਟਡੀ ਕਰਕੇ ਅਤੇ ਫੇਰ ਹੀ ਮੈਂ ਇਹਨੂੰ ਸੀ ਬੀ ਐਸ ਈ 'ਚ ਪਾਇਆ ਏ ਆ ਹਾਂਜੀ ਇਹ ਤਾਂ ਹੈਗਾ ਮੈਂ ਤੁਹਾਡੀ ਗੱਲ ਨਾਲ ਸਹਿਮਤ ਆ ਕਿ ਹੈਗਾ ਆ ਪਰ ਇਹ ਚੀਜ਼ ਹੈ ਕਿ ਆਪਾਂ ਬੱਚੇ ਦੇ ਲਈ ਸਾਰਾ ਕੁਛ ਕਰਦੇ ਆ ਨਾ ਤੁਸੀਂ ਬਾਕੀ ਦੇਖ ਲਓ ਹੈ ਨਾ ਬਾਕੀ ਤੁਹਾਡੀ ਮਰਜ਼ੀ ਚਲੋ ਦੀਦੀ ਮੈਨੂੰ ਕੰਮ ਏ ਆ ਹੁਣ ਹੈ ਨਾ ਚਲੋ ਠੀਕ ਹੈ ਦੀਦੀ ਓਕੇ ਬਾਏ